ਮੈਨੂੰ ਫੋਟੋਗ੍ਰਾਫੀ ਦਾ ਬਹੁਤ ਸ਼ੌਂਕ ਹੈ ਮੈਨੂੰ ਜਦੋਂ ਵੀ ਮੌਕਾ ਮਿਲਦਾ ਹੈ ਤਾਂ ਮੈਂ ਫੋਟੋਗ੍ਰਾਫੀ ਕਰਦਾ ਰਹਿੰਦਾ ਹਾਂ ਅਤੇ ਮੈਂ ਫੋਟੋਗ੍ਰਾਫੀ ਕਰਨ ਲਈ ਵਧੀਆ ਤੋਂ ਵਧੀਆ ਫੋਨ ਵੀ ਲੈਂਦਾ ਰਹਿੰਦਾ ਹਾਂ ਅਤੇ ਕੈਮਰਾ ਵੀ ਲੈਂਦਾ ਹਾਂ ਮੈਂ ਹੁਣੇ ਕੁਝ ਸਮਾਂ ਪਹਿਲਾਂ ਫੋਟੋਗ੍ਰਾਫੀ ਲਈ ਇੱਕ ਸੋਨੀ ਦਾ ਕੈਮਰਾ ਵੀ ਲਿਆ ਸੀ ਹੁਣੇ ਹੁਣੇ ਇੱਕ ਆਈਫੋਨ ਵੀ ਲਿਆ ਸੀ ਜਿਸ ਵਿੱਚ ਮੈਂ ਫੋਟੋਸ ਅਤੇ ਵੀਡੀਓਸ ਬਣਾਉਂਦਾ ਰਹਿੰਦਾ ਹਾਂ ਮੈਂ ਫੋਟੋਸ ਨੂੰ ਐਡਿਟ ਕਰਨ ਲਈ ਵੀ ਕਾਫੀ ਐਪਸ ਐਪ ਯੂਜ਼ ਕਰਦਾ ਹਾਂ ਅਤੇ ਐਡਟਿੰਗ ਕਰਦਾ ਰਹਿੰਦਾ ਹਾਂ